ਸਾਡੇ ਇਲਾਕੇ ਵਿੱਚ ਬਹੁਤ ਜ਼ਿਆਦਾ ਧਰਮ ਹਨ ਜਿਹਨਾਂ ਦੀ ਸਾਰੇ ਲੋਕ ਪਾਲਣਾ ਕਰਦੇ ਹਨ ਕੋਈ ਈਰਖਾ ਨਹੀਂ ਹੈ ਸਾਰੇ ਲੋਕ ਸਭ ਵਰਗ ਦੇ ਧਰਮਾਂ ਦੀ ਆਦਰ ਮਾਣ ਅਤੇ ਸਤਿਕਾਰ ਕਰਦੇ ਹਨ ਪਰ ਸਾਡੇ ਪਿੰਡ ਵਿੱਚ ਸਾਡੇ ਇਲਾਕੇ ਵਿੱਚ ਸਿੱਖ ਧਰਮ ਦਾ ਭਾਈਚਾਰਾ ਸਭ ਤੋਂ ਜ਼ਿਆਦਾ ਹੈ ਅਤੇ ਇਸ ਧਰਮ ਨੂੰ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਹੈ ਸਾਡੇ ਇਲਾਕੇ ਵਿੱਚ ਹੋਰ ਵੀ ਬਹੁਤ ਸਾਰੇ ਧਰਮਾਂ ਹਨ ਜਿੱਦਾਂ ਹਿੰਦੂ ਮੁਸਲਿਮ ਸਿੱਖ ਇਸਾਈ ਇਹ ਸਾਰੇ ਧਰਮ ਪਾਏ ਜਾਂਦੇ ਹਨ ਪਰ ਸਿੱਖ ਧਰਮ ਦੇ ਲੋਕ ਜ਼ਿਆਦਾਤਰ ਵੱਧ ਪਾਏ ਜਾਂਦੇ ਹਨ ਸਾਡੇ ਇਲਾਕੇ ਵਿੱਚ ਅਤੇ ਸਾਡੇ ਸਿੱਖ ਧਰਮ ਦੇ ਲੋਕ ਸਭ ਤੋਂ ਜ਼ਿਆਦਾ ਰਹਿੰਦੇ ਹਨ ਸਾਡੇ ਪਿੰਡ ਦੇ ਸਾਰੇ ਲੋਕ ਗੁਰਦੁਆਰਾ ਸਾਹਿਬ ਜਾਂਦੇ ਹਨ ਸੁਬਹ ਸ਼ਾਮ ਹਰ ਤਰ੍ਹਾਂ ਦਾ ਸਮਾਗਮ ਕਰਮਾਇ ਕਰਵਾਇਆ ਜਾਂਦਾ ਹੈ ਕੋਈ ਵੀ ਕੋਈ ਵੀ ਗੁਰੂ ਦਾ ਕੋਈ ਵੀ ਸੰਤ ਦਾ ਕਿਸੇ ਦਾ ਵੀ ਕੋਈ ਵੀ ਜਨਮਦਿਨ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ ਵਿੱਚ ਅਤੇ ਉਹਨਾਂ ਦੀ ਸਭ ਸਾਰੇ ਸਭ ਤਰੀਕਿਆਂ ਨਾਲ ਪਾਲਣਾ ਕੀਤੀ ਜਾਂਦੀ ਆ ਸਾਰੇ ਆਦਰ ਅਤੇ ਮਾਣ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਜਾ ਕੇ ਨਿਮਰਤਾ ਸਹਿਤ ਬਹਿੰਦੇ ਹਨ ਸੰਗਤ ਵਿੱਚ ਪੰਗਤ ਵਿੱਚ ਲੰਗਰ ਵੀ ਚਲਾਇਆ ਜਾਂਦਾ ਹੈ ਅਤੇ ਸਭ ਧਰਮਾਂ ਦੇ ਲੋਕਾਂ ਨੂੰ ਇੱਕ ਬਰਾਬਰ ਮੰਨਿਆਂ ਜਾਂਦਾ ਹੈ ਕਿਸੇ ਵੀ ਧਰਮ ਨੂੰ ਕੋਈ ਵੀ ਉੱਚਾ ਨੀਵਾਂ ਨਹੀਂ ਦਿਖਾਇਆ ਜਾਂਦਾ ਸਭ ਧਰਮ ਇੱਕ ਬਰਾਬਰ ਹਨ ਪਰ ਸਾਡੇ ਇਲਾਕੇ ਵਿੱਚ ਸਿੱਖ ਧਰਮ ਦੇ ਲੋਕ ਸਭ ਤੋਂ ਜ਼ਿਆਦਾ ਹਨ ਅਤੇ ਸਾਡੇ ਇਲਾਕੇ ਵਿੱਚ ਸਭ ਧਰਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਸਿੱਖ ਧਰਮ ਦੀ ਪਾਲਣਾ ਸਭ ਤੋਂ ਵੱਧ ਕੀਤੀ ਜਾਂਦੀ ਹੈ ਕਿਉਂਕਿ ਇਸ ਲ ਸਾਡੇ ਇਲਾਕੇ ਵਿੱਚ ਸਿੱਖ ਧਰਮ ਦੇ ਲੋਕ ਹੀ ਸਭ ਤੋਂ ਜ਼ਿਆਦਾ ਰਹਿੰਦੇ ਹਨ ਅਤੇ ਭਾਈਚਾਰਾ ਸਭ ਤੋਂ ਜ਼ਿਆਦਾ ਸਿੱਖ ਧਰਮ ਦਾ ਹੀ ਪਾਇਆ ਜਾਂਦਾ ਹੈ ਬਹੁਤ ਬਹੁਤ ਮਾਨਤਾ ਹੈ ਗੁਰੂਆਂ ਸਿੱਖਾਂ ਦੀ ਅਤੇ ਉਹਨਾਂ ਦੇ ਸਾਰੇ ਧਾਰਮਿਕ ਅਸਥਾਨਾਂ 'ਤੇ ਮੱਥਾ ਟੇਕਿਆ ਜਾਂਦਾ ਹੈ ਸਭ ਦੇ ਤਿਉਹਾਰਾਂ ਤਿਉਹਾਰ ਮਨਾਏ ਜਾਂਦੇ ਹਨ ਪਰ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਸਾ ਸਿੱਖ ਭਾਈਚਾਰਾ ਬਹੁਤ ਹੀ ਧਾਰਮਿਕ ਧਾਰਮਿਕ ਭਾਵਨਾਵਾਂ ਨਾਲ ਉਸਨੂੰ ਮਨਾਉਂਦਾ ਹੈ ਅਤੇ ਹੁਣ ਜਿੱਦਾਂ ਪੋਹ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਨੂੰ ਉਹਨਾਂ ਦੇ ਬੱਚਿਆਂ ਦੀ ਸ਼ਹਾਦਤ ਨੂੰ ਬਹੁਤ ਹੀ ਪਿਆਰ ਨਾਲ ਸਤਿਕਾਰ ਨਾਲ ਮਾਣ ਨਾਲ ਸਿਰ ਝੁਕਾ ਕੇ ਮਨਾਇਆ ਜਾਂਦਾ ਹੈ ਇਹਨਾਂ ਦੀ ਪਾਲਣਾ ਬਹੁਤ ਹੀ ਕੀਤੀ ਜਾਂਦੀ ਹੈ ਸਿੱਖ ਭਾਈਚਾਰਾ ਹਰ ਇੱਕ ਧਰਮ ਦੇ ਸਤਿਕਾਰ ਭਾਵਨਾਵਾਂ ਨੂੰ ਸਮਝ ਕੇ ਉਹਨਾਂ ਦਾ ਸਤਿਕਾਰ ਕਰਦਾ ਹੈ ਕਿਸੇ ਨਾਲ ਕੋਈ ਈਰਖਾ ਭਾਵਨਾ ਨਹੀਂ ਰੱਖੀ ਜਾਂਦੀ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਗੋਬਿੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਹੋਰ ਗੁ ਗੁਰੂਆਂ ਗੁਰ ਗੁਰੂਆਂ ਦੀਆਂ ਸ ਗੁਰੂਆਂ ਜੀਆਂ ਦੀਆਂ ਬਾਣੀਆਂ ਨੂੰ ਪ੍ਰਤੱਖ ਰੂਪ ਵਿੱਚ ਪੜ੍ਹਿਆ ਜਾਂਦਾ ਹੈ ਸੁਣਿਆ ਜਾਂਦਾ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਉਹਨਾਂ ਦੀ ਬਾਣੀ ਨੂੰ ਬਹੁਤ ਹੀ ਸਤਿਕਾਰ ਨਾਲ ਪਿਆਰ ਨਾਲ ਸੁਣਿਆ ਜਾਂਦਾ ਹੈ ਗੁਰੂ ਸਾ ਸਾਰੇ ਵਰਗ ਦੇ ਲੋਕ ਗੁਰਦੁਆਰਾ ਘਰ ਵਿੱਚ ਜਾਂ ਗੁਰੂ ਘਰ ਵਿੱਚ ਜਾਂਦੇ ਹਨ ਅਤੇ ਸਤਿਕਾਰ ਭਾਵਨਾਵਾਂ ਨਾਲ ਬਹਿੰਦੇ ਹਨ ਲੰਗਰ ਛਕਦੇ ਹਨ ਹਰ ਤਰ੍ਹਾਂ ਦਾ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹਰ ਕੋਈ ਉੱਥੇ ਲੰਗਰ ਪ੍ਰਸ਼ਾਦਾ ਤਿਆਰ ਕਰਦਾ ਹੈ ਅਤੇ ਛੱਕਦਾ ਹੈ ਪਿਆਰ ਨਾਲ ਕਿਸੇ ਵਿੱਚ ਕੋਈ ਈਰਖਾ ਦੀ ਭਾਵਨਾ ਨਹੀਂ ਪਾਈ ਜਾਂਦੀ ਸਾਰੇ ਵਰਗ ਦੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਸਭ ਦੀ ਪਾਲਣਾ ਕੀਤੀ ਜਾਂਦੀ ਹੈ ਮਾਣ ਕੀਤਾ ਜਾਂਦਾ ਹੈ ਭਾਈਚਾਰਾ ਇਕੱਠਾ ਹੋ ਕੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਪ੍ਰਸ਼ਾਦਾ ਬਣਾਉਂਦਾ ਹੈ ਅਤੇ ਹਰ ਇੱਕ ਸਮਾਗਮ ਨੂੰ ਮਨਾਇਆ ਜਾਂਦਾ ਹੈ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਪਰ ਸਿੱਖ ਧਰਮ ਪੰਜਾਬ ਲਈ ਬਹੁਤ ਹੀ ਸਿੱਖ ਧਰਮ ਪੰਜਾਬ ਦੇ ਸ ਲੋਕਾਂ ਲਈ ਬਹੁਤ ਹੀ ਮਾਨਤਾ ਅਤੇ ਸਤਿਕਾਰ ਰੱਖਦਾ ਹੈ ਸਿ ਪੰਜਾਬ ਵਿੱਚ ਸਿੱਖ ਧਰਮ ਨੂੰ ਸਭ ਤੋਂ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ ਸਭ ਵਰਗਾਂ ਦੇ ਧਰਮਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਪਰ ਸਿੱਖ ਧਰਮ ਪੰਜਾਬ ਵਿੱਚ ਬਹੁਤ ਹੀ ਪ੍ਰਫੁੱਲਿਤ ਅਤੇ ਸਭ ਤੋਂ ਮਹਾਨ ਸਥਾ ਸਥਾਨ ਰੱਖਦਾ ਹੈ